ਮੈਂ ਮੱਧ ਪੀੜੀ ਦਾ ਹਿੱਸਾ ਹਾਂ ਜਦਕਿ ਪੁਰਾਣੀ ਪੀੜੀ ਅਤੇ ਨੌਜਵਾਨ ਪੀੜੀ ਦੇ ਵਿਚਕਾਰ ਅਸੀਂ ਸੰਤੁਲਨ ਰੱਖਣ ਬਾਰੇ ਕਹੀਏ ਤਾਂ ਅੱਜ ਕੱਲ੍ਹ ਦੇ ਬੱਚੇ ਜਿਹੜੇ ਜੰਮਦੇ ਹੀ ਫੋਨ ਬਾਰੇ ਉਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਜਿਵੇਂ ਕਿ ਤਿੰਨ ਚਾਰ ਸਾਲ ਦੇ ਬੱਚੇ ਨੂੰ ਸਭ ਪਤਾ ਹੁੰਦਾ ਹੈ ਕਿ ਫੋਨ ਦਾ ਪਰ ਜਦੋਂ ਸਾਡਾ ਟਾਈਮ ਹੁੰਦਾ ਸੀਗਾ ਸਾਡੇ ਘਰ ਦੇ ਵਿੱਚ ਇੱਕ ਫੋਨ ਇੱਕ ਟੈਲੀਵਿਜ਼ਨ ਹੁੰਦਾ ਸੀਗਾ ਜਿਸ ਵਿੱਚ ਅਸੀਂ ਚਾਰ ਘਰ ਹੁੰਦੇ ਸੀ ਸਾਰੇ ਜਣੇ ਇੱਕ ਜਗ੍ਹਾ ਹੀ ਬੈਠ ਕੇ ਟੀ ਵੀ ਦੇਖਦੇ ਹੁੰਦੇ ਸੀਗੇ ਪਰ ਹੁਣ ਦੇਖਿਆ ਜਾਵੇ ਪਰ ਹਰ ਕੋਈ ਆਪਣੇ ਆਪਣੇ ਹੀ ਕਮਰੇ ਵਿੱਚ ਸਭ ਕੁਛ ਭਾਲਦਾ ਹੈ ਕਿ ਸਾਨੂੰ ਹਰੇਕ ਚੀਜ਼ ਹੀ ਚਾਹੀਦੀ ਆ ਜਦਕਿ ਅੱਗੇ ਸਾਂਝ ਹੁੰਦੀ ਸੀ ਸਾਰਿਆਂ ਦੇ ਨਾਲ ਬਈ ਇੱਕ ਘਰ ਵਿੱਚ ਰਹਿ ਕੇ ਵੀ ਅਸੀਂ ਹੁਣ ਨਹੀਂ ਗੱਲਬਾਤ ਕਰ ਸਕਦੇ ਸਾਰਿਆਂ ਦੇ ਨਾਲ ਅੱਗੇ ਸਾਰੇ ਵੱਖ ਵੱਖ ਰਹਿੰਦੇ ਹੁੰਦੇ ਵੀ ਇਕੱਠੇ ਰਹਿੰਦੇ ਹੁੰਦੇ ਸੀਗੇ ਇੱਕ ਵਿਹੜੇ ਵਿੱਚ ਆ ਕੇ ਸਾਰੇ ਬੈਠਦੇ ਸੀ ਇੱਕ ਅਖਬਾਰ ਪੜ੍ਹਦੇ ਹੁੰਦੇ ਸੀਗੇ ਅਤੇ ਸਾਰੇ ਇਕੱਠੇ ਖਾਂਦੇ ਪੀਂਦੇ ਹੁੰਦੇ ਸੀ ਪਰ ਹੁਣ ਅੱਜ ਕੱਲ੍ਹ ਇੱਦਾਂ ਦਾ ਕੁਛ ਨਹੀਂ ਹੈ ਜਿਹੜੇ ਹੁਣ ਦੇ ਨੌਜਵਾਨ ਆ ਉਹ ਚਾਹੁੰਦੇ ਆ ਕਿ ਅਸੀਂ ਇਕੱਲੇ ਹੀ ਰਹੀਏ ਅਲੱਗ ਅਲੱਗ ਬਹੀਏ ਅਤੇ ਫੋਨ ਵਿੱਚ ਗੇਮਾਂ ਖੇਡੀਏ ਜਿਵੇਂ ਰੰਮੀ ਸਰਕਲ ਵਗੈਰਾ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਅਸੀਂ ਪਿੱਠੂ ਗੇਮ ਖੇਡਦੇ ਹੁੰਦੇ ਸੀਗੇ ਜਾਂ ਰੱਸੀ ਟੱਪਣਾ ਜਾਂ ਕੁਛ ਵੀ ਇੱਦਾਂ ਦੀਆਂ ਗੇ ਖੇਡਾਂ ਖੇਡਦੇ ਹੁੰਦੇ ਸੀ ਸਾਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਸੀ ਕੁਛ